ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪਹਿਲਾਂ ਕਿੱਥੋਂ ਆਏ ਤੁਸੀਂ ਭਾਜੀ ਅੱਛਾ ਜੀ ਅੱਛਾ ਜੀ ਸਭ ਤੋਂ ਪਹਿਲਾਂ ਤਾਂ ਏਅਰਪੋਰਟ ਦੇ ਨੇੜੇ ਸਾਡਾ ਗੁਰਦੁਆਰਾ ਹੀ ਹੈ ਸਿੰਘ ਸ਼ਹੀਦਾਂ ਗੁਰਦੁਆਰਾ ਹੈ ਸਭ ਤੋਂ ਫੇਮੱਸ ਗੁਰਦੁਆਰਾ ਹੈ ਜੀ ਤੁਸੀਂ ਉੱਥੇ ਆਉ ਉੱਥੇ ਦਰਸ਼ਨ ਲਉ ਉੱਥੇ ਲੰਗਰ ਖਾਉ ਤੁਸੀਂ ਹੁਣ ਬਾਹਰੋਂ ਆਏ ਹੋ ਤਾਂ ਲੰਗਰ ਖਾਉ ਤੁਹਾਨੂੰ ਹੋਰ ਵਧੀਆ ਲੱਗੇਗਾ ਹੋਰ ਤਾਂ ਹੋਰ ਉਰੇ ਛੱਤਬੀੜ ਵੀ ਹੈਗੀ ਹੈ ਮੋਹਾਲੀ ਮੋਹਾ ਆਹ ਗੁਰਦੁਆਰੇ ਤੋਂ ਦੂਜੀ ਸਾਈਡ ਹੈ ਜੀ ਜ਼ੀਰਕਪੁਰ ਪਿੰਡ ਹੈ ਜੀ ਜ਼ੀਰਕਪੁਰ ਦੇ ਕੋਲ ਛੱਤ ਪਿੰਡ ਛੱਤ ਪਿੰਡ 'ਚ ਛੱਤਬੀੜ ਹੈ ਜੀ ਉੱਥੋਂ ਤੁਸੀਂ ਗੁਰਦੁਆਰੇ ਆਉ ਮੱਥਾ ਟੇਕੋ ਉੱਥੋਂ ਬੱਸ ਦਾ ਟ੍ਰਾਂਸਪੋਰਟ ਵੀ ਹੈਗਾ ਉੱਥੋਂ ਸਿੱਧਾ ਬੱਸ ਤੁਹਾਨੂੰ ਉੱਥੋਂ ਮਿਲ ਜੇਗੀ ਉਸ ਤੋਂ ਬਾਅਦ ਜੇ ਤੁਸੀਂ ਸ਼ਾਮੀ ਦੇਖਣਾ ਹੈ ਸ਼ਾਮੀ ਲੋਕ ਸੈਰ ਕਰਨ ਜਾਂਦੇ ਹੈ ਲੇਕ 'ਤੇ ਤੁਸੀਂ ਲੇਕ ਵੀ ਜਾ ਸਕਦੇ ਹੋ ਉਹ ਵੀ ਤੁਹਾਨੂੰ ਬੱਸ ਸੋਹਾਣੇ ਤੋਂ ਹੀ ਮਿਲ ਜੂਗੀ ਜਾਂ ਤੁਸੀਂ ਸਿੱਧਾ ਪੁੱਛੋ ਸਤਾਰਾਂ ਬੱਸ ਸਟੈਂਡ 'ਤੇ ਜਾਣਾ ਸਤਾਰਾਂ ਬੱਸ ਸਟੈਂਡ ਤੋਂ ਸਿੱਧਾ ਤੁਸੀਂ ਲੇਕ 'ਤੇ ਜਾਉ ਹਾਂਜੀ ਹਾਂਜੀ ਹਾਂ ਟੈਕਸੀ ਵੀ ਮਿਲ ਜੂਗੀ ਉਬਰ ਕਰਨੀ ਉਬਰ ਕਰ ਲਵੋ ਤੁਸੀਂ ਤੁਹਾਡੇ ਫ਼ੋਨ 'ਚ ਤਾਂ ਉਬਰ ਹੋਵੇਗੀ ਹੋਵੇਗੀ ਤੁਸੀਂ ਸੀਪਲ ਸਿੱਧਾ ਟੈਕਸੀ ਉਬਰ ਕਰੋ ਸਭ ਜਾਉ ਅਤੇ ਉੱਥੇ ਸੁਖਨਾ ਲੇਕ ਦੇ ਨਾਲ਼ ਨਾਲ਼਼ ਰੌਕ ਗਾਰਡਨ ਵੀ ਹੈ ਜੀ ਉੱਥੇ ਜਾਉ ਨੌਰਥ ਸਾਈਡ ਦਾ ਸਭ ਤੋਂ ਵੱਡਾ ਮੌਲ ਹੈ ਨੌਰਥ ਕੰਟਰੀ ਮੌਲ ਤੁਸੀਂ ਉੱਥੇ ਵੀ ਜਾ ਸਕਦੇ ਹੋ ਉਹ ਵੀ ਦੇਖ ਸਕਦੇ ਹੋ ਕਾਫ਼ੀ ਵਧੀਆ ਵਧੀਆ ਵਧੀਆ ਚੀਜ਼ਾਂ ਹੈਗੀਆਂ ਹੈ ਜੇ ਤਾਂ ਤੁਸੀਂ ਟਾਈਮ ਲਗਾ ਸਕਦੇ ਹੋ ਜੀ ਹਾਂਜੀ ਹਾਂਜੀ ਮਤਲਬ ਏਅਰਪੋਰਟ ਦੇ ਨੇੜੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਤੁਸੀਂ ਗੁਰਦੁਆਰੇ ਪਹੁੰਚੋ ਨਾਲੇ ਰੱਬ ਦਾ ਨਾਮ ਵੀ ਲੈ ਹੋ ਜੂਗਾ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਜਰਨੀ ਸ਼ੁਰੂ ਕਰ ਸਕਦੇ ਹੋ ਜਿੱਥੇ ਜਿੱਥੇ ਵੀ ਜਾਣਾ ਤੁਸੀਂ ਲੇਕ 'ਤੇ ਜਾਣਾ ਤਾਂ ਲੇਕ 'ਤੇ ਜਾ ਸਕਦੇ ਹੋ ਜੀ ਹਾਂਜੀ ਹਾਂਜੀ ਬਾਕੀ ਜੇ ਕੋਈ ਲੋੜ ਹੋਵੇ ਤੁਸੀਂ ਮੈਨੂੰ ਫ਼ੋਨ ਕਰ ਸਕਦੇ ਹੋ ਜੀ ਕਦੇ ਵੀ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ